ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲ਼ੋਂ ਪਹਿਲਾਂ ਕੱਪੜੇ ਮੰਗਵਾਏ ਸੀ ਪਹਿਲਾਂ ਬਹੁਤ ਅੱਛੇ ਨਿਕਲ਼ੇ ਪਰ ਹੁਣ ਕੱਪੜਿਆਂ ਦੀ ਪੈਕਿੰਗ ਵੀ ਅੱਛੀ ਨਹੀਂ ਆਈ ਅਤੇ ਸਾਈਜ਼ ਵੀ ਬਿਲਕੁਲ ਠੀਕ ਨਹੀਂ ਸੀ ਅਤੇ ਕੁਆਲਟੀ ਵੀ ਬਿਲਕੁਲ ਘਟੀਆ ਰੇਟ ਵੀ ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਸੀਗਾ ਸਮਾਨ ਪੂਰਾ ਨਹੀਂ ਨਿਕਲਿਆ ਇੱਕ ਟੀ ਸ਼ਰਟ ਨਿਕਲ਼ੀ ਆ ਉਹਦੇ ਨਾਲ਼ ਦੀ ਨਿੱਕਰ ਨਹੀਂ ਨਿਕਲ਼ੀ ਪਰ ਮੈਂ ਤੁਹਾਡੇ ਕੋਲ਼ੋਂ ਅੱਗੇ ਸਮਾਨ ਨਹੀਂ ਮੰਗਵਾਵਾਂਗੀ ਅਤੇ ਹੋਰ ਨੇ ਵੀ ਕਿਸੇ ਨੇ ਮੰਗਵਾਇਆ ਏ ਤਾਂ ਮੈਂ ਉਨ੍ਹਾਂ ਨੂੰ ਵੀ ਰੋਕ ਦੇਵਾਂਗੀ ਪਰ ਇੰਨਾ ਘਟੀਆ ਸਮਾਨ ਸੀ ਬਿਲਕੁਲ ਵੀ ਮੈਨੂੰ ਪਸੰਦ ਨਹੀਂ ਆਇਆ